ਆਪਣੀ ਜ਼ਿੰਦਗੀ ਵਿੱਚ ਮਤਲਬ ਕਲਾ ਬਹੁਤ ਜ਼ਿਆਦਾ ਇੱਕ ਮਹੱਤਵਪੂਰਨ ਮਤਲਬ ਅਹਿਮੀਅਤ ਰੱਖਦੀ ਹੈ ਕਿਉਂਕਿ ਕੀ ਮਤਲਬ ਕਿ ਕਲਾ ਕਲਾ ਇੱਕ ਉਹ ਚੀਜ਼ ਹੁੰਦੀ ਹੈ ਜਿਹਦੇ ਨਾਲ ਮਤਲਬ ਕਿ ਆਪਾਂ ਹਰੇਕ ਬੰਦੇ ਵਿੱਚ ਇੱਕ ਕਲਾ ਹੁੰਦੀ ਹੈ ਕਿਸੇ ਵਿੱਚ ਸਿੰਗਿੰਗ ਦੀ ਹੁੰਦੀ ਹੈ ਡਾਂਸਿੰਗ ਦੀ ਹੁੰਦੀ ਹੈ ਕੁਕਿੰਗ ਦੀ ਹੁੰਦੀ ਹੈ ਭੰਗੜੇ ਦੀ ਹੁੰਦੀ ਆ ਅਤੇ ਪੇਂਟਿੰਗ ਦੀ ਹੁੰਦੀ ਆ ਠੀਕ ਆ ਕਲਾ ਕਲਾ ਮਤਲਬ ਕਿ ਇੱਕ ਹੁੰਦਾ ਹੈ ਕਿ ਉਸ ਉਹ ਬੰਦਾ ਇੱਕ ਚੀਜ਼ ਵਿੱਚ ਮਾਹਿਰ ਹੈ ਮਤਲਬ ਉਹ ਬੰਦੇ ਉਹ ਬੰਦਾ ਇੱਕ ਜਿਵੇਂ ਬੇਸਿਕਲੀ ਹੁਣ ਇਸ ਲਈ ਟੂ ਮੀਂ ਲਾਈਕ ਜਿਵੇਂ ਮੈਂ ਆ ਮੈਂ ਸਿੰਗੀ ਮੈਨੂੰ ਸਿੰਗੀ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹ ਮੇਰੀ ਇੱਕ ਕਲਾ ਹੈ ਮੈਂ ਮਤਲਬ ਕਿ ਮੈਨੂੰ ਸਿੰਗਿੰਗ ਕਰਨਾ ਬੜਾ ਜ਼ਿਆਦਾ ਵਧੀਆ ਵੀ ਲੱਗਦਾ ਹੈ ਮੇਰੀ ਕਲਾ ਹੈਗੀ ਆ ਮੈਂ ਮਤਲਬ ਕਿ ਹਰੇਕ ਕਿਸੇ ਫੰਕਸ਼ਨ ਦੇ ਵਿੱਚ ਸਕੂਲ ਦੇ ਵਿੱਚ ਕੋਲਜ ਦੇ ਵਿੱਚ ਸਿੰਗਿੰਗ ਕਰਨਾ ਬੜਾ ਜ਼ਿਆਦਾ ਮੈਨੂੰ ਵਧੀਆ ਲੱਗਦਾ ਮੈਂ ਸਿੰਗਿੰਗ ਕਰਦੀ ਹੋਈ ਹਾਂ ਠੀਕ ਆ ਉਹ ਮੇਰੀ ਇੱਕ ਕਲਾ ਹੈਗੀ ਆ ਮਤਲਬ ਕਲਾ ਮਹੱਤਵਪੂਰਨ ਇਹ ਰੱਖਦੀ ਹੈ ਕਿ ਇੱਕ ਬੰਦੇ ਦਾ ਇੱਕ ਸਪੈਸੀਫਿਕ ਨਾਮ ਬਣ ਜਾਂਦਾ ਹੈ ਕਿ ਹਾਂ ਯਾਰ ਇਹ ਬੰਦਾ ਇਸ ਚੀਜ਼ ਵਿੱਚ ਬੜਾ ਹੀ ਜ਼ਿਆਦਾ ਪਰਫੈਕਟ ਹੈਗਾ ਹੈ ਠੀਕ ਆ ਜਿਵੇਂ ਕਿ ਸਿੱਧੂ ਮੂਸੇਵਾਲਾ ਉਹ ਗਾਣਾ ਗਾਉਣ ਵਿੱਚ ਬੜਾ ਜ਼ਿਆਦਾ ਵਧੀਆ ਸੀਗਾ ਠੀਕ ਹੈ ਉਹ ਮਤਲਬ ਕਿ ਆਪਣੀ ਸਿੰਗਿੰਗ ਸਿੰਗਿੰਗ ਨੂੰ ਹੀ ਤੋਂ ਜਾਣਿਆ ਜਾਂਦਾ ਆ ਲਾਈਕ ਹੈ ਨਾ ਅਤੇ ਇੱਕ ਸ਼ੇਕਸਪੀਅਰ ਸੀਗੇ ਉਹ ਰਾਈਟਿੰਗ ਤੋਂ ਸੀਗੇ ਠੀਕ ਹੈ ਰਾਈਟਰਸ ਹੁੰਦੇ ਉਹ ਆਪਣੀ ਰਾਈਟਿੰਗ ਤੋਂ ਬੜਾ ਜ਼ਿਆਦਾ ਮਤਲਬ ਕਿ ਜਾਣੇ ਜਾਂਦੇ ਆ ਸਿੰਗਰ ਆਪਣੇ ਸਿੰਗਿੰਗ ਤੋਂ ਜਾਣੇ ਜਾਂਦੇ ਆ ਪੇਂਟਰਜ਼ ਆਪਣੀ ਪੇਂਟਿੰਗ ਤੋਂ ਜਾਣੇ ਜਾਂਦੇ ਆ ਅਤੇ ਉਹ ਦੈਟਸ ਵਾਏ ਜਿਹੜੀ ਮਤਲਬ ਕਿ ਆਪਣੀ ਕਲਾ ਹੈਗੀ ਆ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਆਪਣੀ ਜ਼ਿੰਦਗੀ ਵਿੱਚ ਜਿਹਦੇ ਨਾਲ ਮਤਲਬ ਕਿ ਆਪਾਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਂਦੇ ਹਾਂ ਫਿਊਚਰ ਦੇ ਵਿੱਚ ਡਿਵੈਲਪਮੈਂਟ ਹੁੰਦੀ ਆ ਆਪਣੀ ਆਪਾਂ ਨੇਮ ਗੈਟ ਕਰਦੇ ਹਾਂ ਆਪਾਂ ਫੇਮ ਗੈਟ ਕਰਦੇ ਹਾਂ ਅਤੇ ਮਤਲਬ ਅੱਗੇ ਜਾ ਕੇ ਆਪਾਂ ਨੂੰ ਸਹਾਇਤਾ ਵੀ ਮਿਲਦੀ ਆ ਆਪਣੇ ਆਪ ਨੂੰ ਥੋੜ੍ਹਾ ਮਤਲਬ ਸ਼ਾਈਨ ਕਰਨ ਵਾਸਤੇ ਬਰੂਮਿੰਗ ਕਰਨ ਵਾਸਤੇ ਐਂਡ ਐਕਸੈਕਟ੍ਰਾ